ਚੋਣਾਂ ਦੌਰਾਨ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਚੋਣਾਂ ਦੌਰਾਨ ਅਲੱਗ ਅਲੱਗ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤੇ ਜਾਂਦੇ ਹਨ ਇਹ ਚੋਣ ਪ੍ਰਚਾਰ ਲਾਊਂਡ ਸਪੀਕਰਾਂ ਰਾਹੀਂ ਉੱਚੀ ਉੱਚੀ ਕਰਵਾਉਂਦੇ ਹਨ ਜਿਸ ਨਾਲ ਬਜ਼ੁਰਗ ਬੱਚੇ ਅਤੇ ਸਕੂਲੀ ਜਾਣ ਵਾਲੇ ਬੱਚੇ ਵੀ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ ਇਹੀ ਨਹੀਂ ਇਹ ਅਲੱਗ ਅਲੱਗ ਉਮੀਦਵਾਰਾਂ ਦੇ ਪ੍ਰਚਾਰ ਕਰਨ ਕਰਕੇ ਬਹੁਤ ਸਾਰੀਆਂ ਲੜਾਈਆਂ ਝਗੜੇ ਵੀ ਹੁੰਦੇ ਹਨ ਜਿਸ ਦਿਨ ਚੋਣਾਂ ਪੈਣੀਆਂ ਹੁੰਦੀਆਂ ਹਨ ਉਸ ਦਿਨ ਆਮ ਲੋਕਾਂ ਨੂੰ ਆਪੋ ਆਪਣੇ ਬੂਥਾਂ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ ਜਿਸ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ